ਮੈਂ ਆਪਣੀ ਫੋਕਲ ਥਕਾਵਟ ਨੂੰ ਠੀਕ ਕਰਨ ਲਈ ਰੋਜ ਸਵੇਰੇ ਗਰਮ ਪੋਣੀ ਪਾਣੀ ਪੀਂਦਾ ਹਾਂ ਅਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨਾਲ ਉੱਚੀ ਅਵਾਜ਼ 'ਚ ਗੱਲ ਨਾ ਕਰਾਂ ਕਿਉਂਕਿ ਕਿਤੇ ਨਾ ਕਿਤੇ ਇਹ ਸਾਡੀ ਵੋਕਲ ਨੂੰ ਥਕਾ ਦਿੰਦੀਆਂ ਹਨ ਅਤੇ ਵੋਕਲ ਉੱਤੇ ਬੁਰਾ ਅਸਰ ਪਾਉਂਦੀਆਂ ਹਨ ਮੈਂ ਆਪਣੀ ਵੋਕਲ ਦੀ ਥਕਾਵਟ ਲਈ ਹਮੇਸ਼ਾ ਹੀ ਧਿਆਨ ਕਰਦਾ ਹਾਂ ਕਿਉਂਕਿ ਇਹ ਧਿਆਨ ਮੈਨੂੰ ਕਿਤੇ ਨਾ ਕਿਤੇ ਇੱਕ ਸ਼ਕਤੀ ਦਿੰਦਾ ਹੈ ਕਿ ਮੈਂ ਆਪਣੇ ਵੋਕਲ 'ਤੇ ਚੰਗਾ ਅਸਰ ਪਾ ਸਕਾਂ ਅਤੇ ਇੱਕ ਸੁਰੀਲੀ ਅਵਾਜ਼ ਵਿੱਚ ਗਾਣਾ ਪੇਸ਼ ਕਰ ਸਕਾਂ ਆਪਣੀ ਅਵਾਜ਼ ਦੀ ਸੁਰੱਖਿਆ ਲਈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਬਾਹਰ ਦੀਆਂ ਚੀਜ਼ਾਂ ਘੱਟ ਤੋਂ ਘੱਟ ਖਾਵਾਂ ਅਤੇ ਹਮੇਸ਼ਾ ਹੀ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਵਾਂ ਜਿਵੇਂ ਕਿ ਮੇਰੇ ਮੰਮੀ ਦੇ ਬਣਾਇਆ ਹੋਇਆ ਖਾਣਾ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਹਮੇਸ਼ਾ ਇਹ ਹੀ ਖਾਵਾਂ ਅਤੇ ਬਾਹਰ ਦੀਆਂ ਚੀਜ਼ਾਂ ਯਾਨੀ ਕਿ ਸਪਰਿੰਗ ਰੋਲ ਮੋਮੋਸ ਇਹ ਸਭ ਕਦੇ ਵੀ ਨਾ ਖਾਵਾਂ